ਪੰਜਾਬੀ ਪ੍ਰਾਂਤਾਂ ਰਵਾਇਤੀ ਤਰੀਕੇ ਨਾਲ ਜਿਹੜੇ ਲਾੜੀ ਨੂੰ ਵਿਆਹ ਦੇ ਸਮੇਂ ਘਰ ਦੀਆਂ ਜ਼ਰੂਰੀ ਵਸਤਾਂ ਦੇ ਉਪਹਾਰ ਦਿੱਤੇ ਜਾਂਦੇ ਸੀ ਜਿਵੇਂ ਘਰ ਦੇ ਬਰਤਨ ਹੋ ਗਏ ਜਿਵੇਂ ਰਜਾਈਆਂ ਗਲਾਫ ਕੰਬਲ ਘਰ ਦੀਆਂ ਕੱਢੀਆਂ ਗਈਆਂ ਦਰੀਆਂ ਕੱਪੜੇ ਘਰ ਦੇ ਬਰਤਨ ਇਹੋ ਜਿਹੇ ਸਮਾਨ ਜਿਹੜੇ ਪੁਰਾਤਨ ਰੀਤੀ ਰਿਵਾਜ਼ਾਂ ਮੁਤਾਬਿਕ ਦਿੱਤੇ ਜਾਂਦੇ ਸੀ ਬਾਕੀ ਅੱਜ ਕੱਲ੍ਹ ਦੇ ਯੁੱਗ ਅਜੋਕੇ ਯੁੱਗ ਵਿੱਚ ਥੋੜ੍ਹੇ ਜਿੰਨੇ ਉਪਹਾਰ ਦੀ ਦੇਣ ਵੀ ਰਿਸ਼ਤੇਦਾਰਾਂ ਦੀ ਬਦਲੀ ਹੈ ਅੱਗੇ ਭਾਂਡੇ ਜਿਹੜੇ ਹੁੰਦੇ ਸੀ ਉਹ ਕੇ ਤਾਂਬੇ ਪਿੱਤਲ ਆਦਿ ਦੇ ਦਿੱਤੇ ਜਾਂਦੇ ਸੀ ਅੱਜ ਕੱਲ੍ਹ ਜਿਹੜੇ ਆ ਉਹ ਸਟੀਲ ਦੇ ਹੋ ਗਏ ਨੇ ਜਾਂ ਹੋਰ ਅਨਬਰੇਕੇਬਲ ਹੋ ਗਏ ਨੇ ਡਿਨਰ ਸੈੱਟ ਹੋ ਗਏ ਨੇ ਇਸ ਤਰ੍ਹਾਂ ਦੇ ਭਾਂਡੇ ਦਿਤ ਦੇਣੇ ਸ਼ੁਰੂ ਹੋ ਗਏ ਨੇ ਪਹਿਲੇ ਯੁੱਗ ਵਿੱਚ ਜ਼ਿਆਦਾਤਰ ਤਾਂਬ ਤਾਂਬਾ ਲੋਹ ਪਿੱਤਲ ਕੇ ਇਹਏ ਇੱਦਾਂ ਦੇ ਬਰਤਨ ਦਿੱਤੇ ਜਾਂਦੇ ਸੀ ਜਿਨ੍ਹਾਂ ਵਿੱਚ ਗਲਾਸ ਕੋਲੀਆਂ ਪਲੇਟਾਂ ਚਮਚੇ ਇਹ ਇੱਦਾਂ ਦੇ ਸੀ ਅਤੇ ਜਿਹੜੇ ਰਿਸ਼ਤੇਦਾਰ ਸੀ ਉਹ ਉਹ ਵੀ ਇਸ ਤਰ੍ਹਾਂ ਦੇ ਹੀ ਉਪਹਾਰ ਵਜੋਂ ਨਕਦੀ ਦੇ ਦਿੰਦੇ ਸੀ ਕੁੜੀ ਨੂੰ ਜਾਂ ਮ ਅ ਜਿਹੜੇ ਰਿਸ਼ਤੇਦਾਰ ਹੁੰਦੇ ਸੀ ਜਿਵੇਂ ਸਿਰ 'ਤੇ ਦੁਪੱਟੇ ਲੈਣ ਲਈ ਵ ਵਧੀਆ ਫੁਲਕਾਰੀ ਹੁੰਦੀ ਸੀ ਉਹ ਦੇ ਦਿੰਦੇ ਸੀ ਅਤੇ ਹੋਰ ਵੀ ਇਸ ਤਰ੍ਹਾਂ ਦੇ ਸਮਾਨ ਜ਼ਰੂਰੀ ਘਰੇਲੂ ਵਸਤੂਆਂ ਜੋ ਬਹੁਤ ਹੀ ਜ਼ਰੂਰੀ ਹੁੰਦੀਆਂ ਸੀ ਉਹ ਦਿੱਤੀਆਂ ਜਾਂਦੀਆਂ ਸੀ ਅਜੋਕੇ ਯੁੱਗ ਵਿੱਚ ਦਾਜ ਪੰਜਾਬ ਵਿੱਚ ਕੋਈ ਪ੍ਰਥਾ ਨਹੀਂ ਹੈ ਲੋੜ ਮੁਤਾਬਿਕ ਹੀ ਦਿੱਤਾ ਜਾਂਦਾ ਹੈ ਦ ਦਾਜ ਦਹੇਜ ਦੇ ਖਿਲਾਫ਼ ਪੰਜਾਬ ਸ਼ੁਰੂ ਤੋਂ ਹੀ ਰਿਹਾ ਵਾ ਅਤੇ ਹੁਣ ਵੀ ਖੜਾ ਹੁੰਦਾ ਹੀ ਹੈ ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ ਇਹ ਮਾਂ ਪਿਓ ਜਿਹੜਾ ਆਪਣੇ ਬੱਚਿਆਂ ਨੂੰ ਸਮਾਨ ਦਿੰਦਾ ਹੈ ਉਹ ਸਿਰਫ਼ ਉਹਦੀ ਨਿੱਜੀ ਜ਼ਰੂਰਤਾਂ ਲਈ ਦਿੰਦਾ ਹੈ ਨਾ ਕਿ ਉਹ ਦਾਜ ਦੇ ਤੌਰ 'ਤੇ ਦਿੰਦਾ ਹੈ ਕਿ ਉਹਦੀ ਧੀ ਆਪਣੀ ਜ਼ਰੂਰਤ ਵਾਲੀਆਂ ਚੀਜ਼ਾਂ ਜੋ ਉਹਨੂੰ ਜ਼ਰੂਰੀ ਆ ਅਗਲੇ ਘਰ ਜਾ ਕੇ ਉਹ ਆਪਣੇ ਆ ਵਰਤ ਸਕੇ ਹੋਰ ਪੁਰਾਣੇ ਯੁੱਗ ਵਿੱਚ ਘਰ ਦੀ ਬੁਣਤੀ ਵਾਲੇ ਬੈੱਡ ਦਿੱਤੇ ਜਾਂਦੇ ਸੀ ਅੱਜ ਕੱਲ੍ਹ ਵੀ ਦਿੱਤੇ ਜਾਂਦੇ ਹਨ ਡਬਲ ਬੈੱਡ ਸੋਫਾ ਸੈੱਟ ਇਸ ਤਰ੍ਹਾਂ ਲੋੜੀਂਦੀਆਂ ਚੀਜ਼ਾਂ ਦਿੱਤੀਆਂ ਜਾਂਦੀਆਂ ਹਨ ਧੰਨਵਾਦ ਸ਼ੁਕਰੀਆ